ਰੋਪੜ ਜਿਹੜਾ ਸਾਡਾ ਸ਼ਹਿਰ ਹੈ ਤਾਂ ਇਹਨੂੰ ਰੋ ਰੋਪੜ ਦੇ ਨਾਂ 'ਤੇ ਰੂਪਨਗਰ ਵੀ ਕਹਿੰਦੇ ਹੈ ਰੋਪੜ ਵੀ ਕਹਿੰਦੇ ਹੈ ਸਭ ਤੋਂ ਵੱਡੀ ਇਹਦੀ ਜਿਹੜੀ ਖਾਸੀਅਤ ਹੈ ਉਹ ਹੈ ਆਪਣਾ ਅੰਗਰੇਜ਼ਾਂ ਔਰ ਪੰਜਾਬੀਆਂ ਦੇ ਵਿੱਚ ਜਿਹੜੀ ਸੰਧੀ ਹੋਈ ਸੀ ਜਿਹਨੂੰ ਕਹਿੰਦੇ ਸੀ ਰਣਜੀਤ ਸਿੰਘ ਦੇ ਨਾਂ ਦੇ ਨਾਲ ਸੰਧੀ ਹੋਈ ਸੀ ਉਹ ਜਿਹੜਾ ਸਥਾਨ ਹੈ ਉਹ ਰੋਪੜ ਦੇ ਵਿੱਚ ਸੁਸ਼ੋਭਿਤ ਹੈ ਸਤਲੁਜ ਦਰਿਆ ਦੇ ਕਿਨਾਰੇ ਹੈ ਸਤਲੁਜ ਰੋਪੜ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਠੀਕ ਹੈ ਇਹ ਜਿਹੜੀ ਵਿੱਚ ਮੇਨ ਜਿਹੜੀ ਇਹਦੀ ਜਾਂ ਜਿਹੜੀ ਖਾਸੀਅਤ ਹੈ ਇਹ ਜਿਹੜੀ ਹੈ ਅੰਗਰੇਜ਼ਾਂ ਔਰ ਪੰਜਾਬੀਆਂ ਦੇ ਪੰਜਾਬ ਦੇ ਵਿੱਚ ਜਿਹੜੀ ਸੰਧੀ ਹੋਈ ਸੀ ਰਣਜੀਤ ਸਿੰਘ ਔਰ ਅੰਗਰੇਜ਼ਾਂ ਦੇ ਵਿੱਚ ਸੰਧੀ ਹੋਈ ਸੀ ਉਹਦਾ ਸੁਸ਼ੋਭਿਤ ਨਿਸ਼ਾਨ ਹੈ ਅਤੇ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਹੈ